ਇੱਕ ਵਾਰੀ ਮੈਂ ਇੰਸਟਾਗ੍ਰਾਮ ਚਲਾ ਰਹੀ ਸੀ ਦੈਂਨ ਇੰਸਟਾਗ੍ਰਾਮ 'ਤੇ ਮੈਂ ਬਹੁਤ ਜੁਵੇਲਰੀ ਵਾਲੀਆਂ ਚੀਜ਼ਾਂ ਦੇਖਦੀ ਰਹਿੰਦੀ ਹਾਂ ਅਤੇ ਇੱਕ ਵਾਰੀ ਮੈਨੂੰ ਇੱਕ ਲੋਕਿਟ ਦਿਖਿਆ ਚਿੱਟੇ ਰੰਗ ਦਾ ਸੀ ਮਤਲਬ ਉਹਦੇ ਉੱਤੇ ਉੱਤੇ ਵਾਈਟ ਕਲਰ ਦਾ ਫੋਲਾਵਰ ਬਣਿਆ ਹੋਇਆ ਸੀ ਮੈਨੂੰ ਬੜਾ ਪਿਆਰਾ ਜਿਹਾ ਲੱਗਿਆ ਉਹ ਅਤੇ ਉਹ ਫੋਟੋ ਵੀ ਫੋਟੋ ਵਿੱਚ ਤਾਂ ਬਹੁਤ ਅੱਛਾ ਜਿਹਾ ਲੱਗ ਰਿਹਾ ਸੀਗਾ

ਤਾਂ ਮੈਂ ਉੱਥੇ ਤੋਂ ਆਰਡਰ ਕਰ ਦਿੱਤਾ ਅਤੇ ਦੋ ਕੁ ਹਫਤੇ ਬਾਅਦ ਉਹ ਮੇਰੇ ਘਰ ਆਇਆ ਅਤੇ ਜਦ ਮੈਂ ਦੇਖਿਆ ਤਾਂ ਉਹ ਲੋਕਿਟ ਮੈਨੂੰ ਥੋ ਚੰਗਾ ਨਹੀਂ ਲੱਗਿਆ ਕਿਉਂਕਿ ਫੋਟੋ 'ਚ ਉਹ ਬੜਾ ਸੋਹਣਾ ਲੱਗ ਰਿਹਾ ਸੀ ਪਰ ਜਦ ਮੈਂ ਉਵੇਂ ਉਹਨੂੰ ਹੱਥ 'ਚ ਫੜ ਕੇ ਦੇਖਿਆ ਤਾਂ ਉਹਦੀ ਕੁਆਲਟੀ ਵੀ ਐਨੀ ਅੱਛੀ ਨਹੀਂ ਸੀਗੀ ਨਾਲੇ ਮੈਨੂੰ ਲੱਗਿਆ ਸ਼ਾਇਦ ਉਹਦਾ ਸਾਈਜ਼ ਥੋੜ੍ਹਾ ਵੱਡਾ ਹੋਊਗਾ ਬਟ ਉਹ ਥੋੜ੍ਹਾ ਛੋਟਾ ਸਾਈਜ਼ ਸੀ ਦੈਂਨ ਮੈਂ ਉਹਨਾਂ ਨੂੰ ਮੈਸਜ ਵਗੈਰਾ ਕਰਕੇ ਵੀ ਉਹਨਾਂ ਨੂੰ ਕੰਪਲੇਟ ਵੀ ਕੀਤੀ ਕਿ ਮੈਂ ਇਹ ਵਾਪਸ ਕਰਨਾ ਚਾਹੁੰਦੀ ਹਾਂ ਬਟ ਉਹ ਵਾਪਸ ਨਹੀਂ ਹੋਇਆ ਉਹ ਕਹਿੰਦੇ ਕਿ ਹੁਣ ਰਿਫੰਡ ਨਹੀਂ ਵਗੈਰਾ ਕੁਛ ਹੋਣਾ ਨਹੀਂ ਹੈਗਾ ਅਤੇ ਮੈਨੂੰ ਬੜਾ ਬੁਰਾ ਲੱਗਿਆ ਕਿਉਂਕਿ ਪਹਿਲਾ ਤਾਂ ਰਿਫੰਡ ਦੀ ਆਪਸ਼ਨ ਵੀ ਉਸ 'ਚ ਸ਼ੋ ਹੋ ਰਹੀ ਸੀ ਤਾਂ ਮੈਂ ਸੋਚਿਆ ਕਿ ਜੇ ਨਹੀਂ ਚੰਗਾ ਲੱਗਿਆ ਤਾਂ ਰਿਫੰਡ ਕਰ ਦੇਵਾਂਗੀ ਬਟ ਹੁਣ ਉਹਦੇ ਵਿੱਚ ਰਿਫੰਡ ਵੀ ਨਹੀਂ ਹੋਣਾ ਤਾਂ ਮੇਰਾ ਐਕਸਪੀਰੀਐਂਸ ਬਹੁਤ ਖੱਟਾ ਜਿਹਾ ਰਿਹਾ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਿਆ